ਗੰਭੀਰ ਮੌਸਮ ਖਰਾਬ ਕਰਕੇ ਘਰਦੀਆਂ ਸਾਰੀਆਂ ਤਾਰਾਂ ਫੋਨ ਸਭ ਖਰਾਬ ਹੋਏ ਪਏ ਨੇ ਕੋਈ ਲੈਂਡ ਨੰਬਰ ਚੱਲ ਹੀ ਨਹੀਂ ਰਿਹਾ ਹੈਗਾ ਬਿੱਲ ਇੰਨਾ ਆਈ ਜਾਂਦਾ ਬਿੱਲ ਤੁਸੀ ਦਈ ਜਾਂਦੇ ਹੋ ਅਸੀ ਕੀ ਕਰੀਏ ਉੱਧਰੋ ਮੋਬਾਇਲਾਂ ਦੇ ਟਾਵਰ ਨਹੀਂ ਚੱਲ ਰਹੇ ਮੌਸਮ ਖਰਾਬ ਹੈਗਾ ਬਾਰਿਸ਼ਾਂ ਆਈ ਜਾ ਰਹੀਆਂ ਨੇ ਹੁਣ ਤੁਸੀਂ ਦੱਸੋ ਹੁਣ ਕੀ ਕਰੀਏ ਕੀ ਨਾ ਕਰੀਏ ਕਦੀ ਕੁਛ ਕਦੀ ਕੁਛ ਇੰਨੀਆਂ ਤਾਰਾਂ ਫੈਲੀਆਂ ਪਈਆਂ ਨੇ ਨਾ ਕੋਈ ਤਾਰ ਦਾ ਕੋਈ ਹੈ ਸਿਸਟਮ ਨਾ ਪਤਾ ਚੱਲ ਰਿਹਾ ਮੇਰੀ ਤਾਰ ਕਿਸੀ ਦੇ ਤਾਰ ਨਾਲ ਜੁੜੀ ਹੋਈ ਹੈ ਸਾਡੀ ਤਾਰ ਕਿਸੇ ਦੇ ਤਾਰ ਨਾਲ ਜੁੜੀ ਹੋਈ ਹੈ ਉਹਨਾਂ ਦਾ ਬਿਲ ਸਾਡੇ ਵੱਲ ਆਈ ਜਾਂਦਾ ਸਾਡਾ ਬਿਲ ਉਹਨਾਂ ਵੱਲ ਆਈ ਜਾਂਦਾ ਪਤਾ ਨਹੀਂ ਕੁਛ ਨਹੀਂ ਸਮਝ ਆ ਰਿਹਾ ਸਭ ਤਕਨੀਕੀ ਖਰਾਬ ਹੋਈ ਪਈ ਤੁਸੀਂ ਕੁਛ ਤਾਂ ਕਰੋ ਕੁਛ ਤਾਂ ਕਰੋ